ਮੈਂ ਅੱਜ ਸਵੇਰੇ ਹੀ ਇੱਕ ਔਡਰ ਦਿੱਤਾ ਸੀ ਜੋ ਕਿ ਮੇਰੇ ਦੋਸਤਾਂ ਲਈ ਸੀ ਅਤੇ ਜਿਨ੍ਹਾਂ ਨੂੰ ਮੈਂ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਮਿਲੀ ਸੀ ਅਤੇ ਮੈਂ ਸੋਚਿਆ ਕਿ ਉਹ ਸਾਰੇ ਵੈੱਜ ਹੋਣਗੇ ਅਤੇ ਉਹ ਸਾਰੇ ਹੈਲਦੀ ਹੋਣਗੇ ਪਰ ਜਦੋਂ ਉਹ ਪਹੁੰਚੇ ਉਹਨਾਂ ਵਿੱਚੋਂ ਕੁਛ ਤਾਂ ਨਹੀਂ ਆਏ ਪਰ ਜੋ ਆਏ ਉਹਨ ਉਹਨਾਂ ਵਿੱਚੋਂ ਕਿਸੇ ਕਿਸੇ ਦੋ ਨੂੰ ਅਲੱਗ ਅਲੱਗ ਚੀਜ਼ਾਂ ਬਹੁਤ ਸਾਰੀਆਂ ਆਈਟਮ ਤੋਂ ਐਲਰਜੀ ਸੀ ਸੋ ਮੈਂ ਉਹਨਾਂ ਵਾਲੇ ਚੀਜ਼ਾਂ ਨੂੰ ਚਾਹੁੰਦੀ ਹਾਂ ਕਿ ਤੁਸੀਂ ਹੋਰ ਚੀਜ਼ਾਂ ਨਾਲ਼ ਰਿਪਲੇਸ ਕਰ ਦਿਓ ਪਹਿਲੇ ਹੀ ਤਾਂ ਮੇਰੇ ਦੋ ਦੋਸਤਾਂ ਨੂੰ ਮਸ਼ਰੂਮ ਤੋਂ ਐਲਰਜੀ ਹੈ ਸੋ ਮੈਂ ਚਾਹੁੰਦੀ ਹਾਂ ਕਿ ਜਿਨ੍ਹਾਂ ਵੀ ਚੀਜ਼ਾਂ ਜਿਵੇਂ ਕਿ ਪੀਜ਼ਾ ਦੇ ਵਿੱਚ ਜਿਸ ਵਿੱਚ ਮਸ਼ਰੂਮ ਪੈਂਦਾ ਹੈ ਉਸਨੂੰ ਕਿਸੇ ਹੋਰ ਚ ਉਸਦੀ ਜਗ੍ਹਾ ਕੋਈ ਹੋਰ ਚੀਜ਼ ਪਾ ਦਿਓ ਜਾਂ ਪੀਜ਼ੇ ਨੂੰ ਵਿੱਚੋਂ ਹੀ ਹਟਾ ਦਿਓ ਅਤੇ ਦੂਜਾ ਇੱਕ ਇੱਕ ਰੈੱਡ ਸੋਸ ਵਾਲੇ ਪਾਸਤੇ ਤੋਂ ਮੇਰੇ ਮੇਰੇ ਸ ਰੈੱਡ ਸੋਸ ਪਾਸਤਾ ਮੇਰੇ ਇੱਕ ਫਰੈਂਡ ਨੂੰ ਬਿਲਕੁਲ ਵੀ ਪਸੰਦ ਨਹੀਂ ਹੈ ਸੋ ਉਸ ਲਈ ਰੈੱਡ ਸੋਸ ਵਾਲੇ ਪਾਸਤੇ ਦੀ ਜਗ੍ਹਾ ਵਾਈਟ ਸੋਸ ਦ ਵਾਈਟ ਸੋਸ ਪਾਸਤਾ ਔਡਰ ਕਰ ਦਿਓ